ਜਿਵੇਂ ਕਿ ਸਾਨੂੰ ਪਤਾ ਹੈ ਕਿ ਇੱਕ ਬੱਚਾ ਜੋ ਹੈ ਉਹ ਜਦੋਂ ਬੋਲਣਾ ਸਿੱਖਦਾ ਹੈ ਤਾਂ ਸਭ ਤੋਂ ਪਹਿਲੀ ਭਾਸ਼ਾ ਆਪਣੀ ਮਾਤਰ ਭਾਸ਼ਾ ਸਿੱਖਦਾ ਹੈ ਅਤੇ ਸਾਡੀ ਮਾਤਰ ਭਾਸ਼ਾ ਜੋ ਹੈ ਉਹ ਪੰਜਾਬੀ ਹੈ ਬਟ ਅੱਜ ਕੱਲ੍ਹ ਦੇ ਮਾਪੇ ਪੰਜਾਬੀ ਨੂੰ ਛੱਡ ਕੇ ਆਪਣੇ ਬੱਚੇ ਨੂੰ ਹੋਰ ਭਾਸ਼ਾਵਾਂ ਜਿਵੇਂ ਕਿ ਅ ਇੰਗਲਿਸ਼ ਜਾਂ ਫਿਰ ਹਿੰਦੀ ਵੱਲ ਨੂੰ ਧੱਕਦੇ ਨੇ ਬਟ ਮਾਪਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਬੱਚਾ ਆਪਣੀ ਮਾਤਰ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੋਲ ਸਕਦਾ ਉਹ ਦੁਨੀਆਂ ਦੀ ਹੋਰ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖ ਪਾਏਗਾ ਅੱਗੇ ਜਾ ਕੇ ਸਕੂਲਾਂ ਦੇ ਵਿੱਚ ਵੀ ਉਹ ਇੰਗਲਿਸ਼ ਮੀਡੀਅਮ ਸਕੂਲਸ ਦੇ ਵਿੱਚ ਪੰਜਾਬੀ ਨੂੰ ਬੋਲਣਾ ਜੋ ਹੈ ਉਹ ਗਲਤ ਸਮਝਦੇ ਨੇ ਬੱਚਿਆਂ ਦੇ ਦਿਮਾਗ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਜੋ ਬੱਚਾ ਪੰਜਾਬੀ ਬੋਲਦਾ ਹੈ ਉਹ ਬੱਚਾ ਜੋ ਹੈ ਉਹ ਘੱਟ ਇੰਟੈਲੀਜੈਂਟ ਜਾਂ ਫਿਰ ਅ ਘੱਟ ਪੜ੍ਹਿਆ ਲਿਖਿਆ ਹੈ ਅਤੇ ਜੋ ਇੰਗਲਿਸ਼ ਬੋਲਦਾ ਹੈ ਉਹ ਜ਼ਿਆਦਾ ਪੜ੍ਹਿਆ ਲਿਖਿਆ ਹੈ ਇਸ ਨਾਲ ਮਾਤਰ ਭਾਸ਼ਾ ਦੇ ਪ੍ਰਤੀ ਜੋ ਬੱਚੇ ਦੇ ਮਨ ਦੇ ਵਿੱਚ ਲਗਾਵ ਹੋਣਾ ਚਾਹੀਦਾ ਹੈ ਉਹ ਖਤਮ ਹੋ ਜਾਵੇਗਾ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਬੱਚੇ ਨੂੰ ਸਭ ਤੋਂ ਪਹਿਲੀ ਭਾਸ਼ਾ ਜੋ ਹੈ ਉਹ ਮਾਤਰ ਭਾਸ਼ਾ ਸਿਖਾਉਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਬਾਕੀ ਭਾਸ਼ਾਵਾਂ ਵੱਲ ਭੇਜਣਾ ਚਾਹੀਦਾ ਹੈ ਆਪਣੀ ਮਾਤਰ ਭਾਸ਼ਾ ਦਾ ਮਹੱਤਵ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਸ਼ਿਖਸ਼ਾ ਪ੍ਰਣਾਲੀ ਦੇ ਵਿੱਚ ਵੀ ਮਾਤਰ ਭਾਸ਼ਾ ਦੇ ਮਹੱਤਵ ਨੂੰ ਲੈ ਕੇ ਅਲੱਗ ਤੋਂ ਸਿੱਖਿਆ ਦੇਣੀ ਚਾਹੀਦੀ ਹੈ ਮਾਤਰ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਅਲੱਗ ਅਲੱਗ ਫੰਕਸ਼ਨਸ ਹੋਣੇ ਚਾਹੀਦੇ ਨੇ ਬੱਚੇ ਨੂੰ ਆਪਣੀ ਮਾਤਰ ਭਾਸ਼ਾ ਦੇ ਵਿੱਚ ਕਵਿਤਾਵਾਂ ਬੋਲਣੀਆਂ ਜਾਂ ਫਿਰ ਕਹਾਣੀਆਂ ਬੋਲਣ ਦੇ ਲਈ ਪ੍ਰਭਾਵਿਤ ਕਰਨਾ ਚਾਹੀਦਾ ਹੈ ਨਾ ਕਿ ਉਸ ਬੱਚੇ ਨੂੰ ਉਸ ਦੀ ਮਾਤਰ ਭਾਸ਼ਾ ਬੋਲਣ ਤੋਂ ਰੋਕਣਾ ਚਾਹੀਦਾ ਹੈ ਜਿਸ ਨਾਲ ਉਸ ਦੇ ਮਨ ਵਿੱਚ ਮਾਤਰ ਭਾਸ਼ਾ ਦੇ ਪ੍ਰਤੀ ਜੋ ਹੈ ਉਹ ਨਫਰਤ ਫੈਲੇ ਆਪਣੀ ਮਾਤਰ ਭਾਸ਼ਾ ਬੋਲਣਾ ਜੋ ਹੈ ਉਹ ਬੱਚੇ ਲਈ ਇੱਕ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਇੱਕ ਅਪਮਾਨ ਦੀ ਗੱਲ